ਕਈ ਸਾਲਾਂ ਤੋਂ ਹੁਣ ਫੋਟੋਗ੍ਰਾਫੀ ਦੇ ਵਿੱਚ ਬਹੁਤ ਸਾਰੇ ਚੇਂਜਿਸ ਆਏ ਹਨ ਜਿਵੇਂ ਕਿ ਪਹਿਲਾਂ ਨਾਇੰਨਟੀਸ ਦੇ ਟਾਈਮ 'ਚ ਅ ਸਾਡੀਆਂ ਫੋਟੋਜ ਜਿਹੜੀਆਂ ਆਉਂਦੀਆਂ ਸੀਗੀਆਂ ਬਲੈਕ ਐਂਡ ਵਾਈਟ ਆਈ ਦੀਆਂ ਸੀਗੀਆਂ ਫਿਰ ਉਹਦੇ ਬਾਅਦ ਟੈਕਨੋਲੋਜੀ ਵਧੀ ਜਿਹਦੇ ਕਰਕੇ ਕਿ ਸਾਡੀਆਂ ਫੋਟੋਜ ਦੇ ਵਿੱਚ ਸ ਕਲਰ ਕਲਰ ਐਡ ਹੋਏ ਫਿਰ ਉਹਦੇ ਬਾਅਦ ਲੋਕ ਕੀ ਕਰਦੇ ਸੀਗੇ ਵੱਡੇ ਮਹਿੰਗੇ ਮਹਿੰਗੇ ਕੈਮਰੇ ਖਰੀਦਦੇ ਸੀਗੇ ਜਿਹਦੇ ਕਰਕੇ ਕਿ ਜਿਹਦੇ ਕਰਕੇ ਉਹ ਫੋਟੋ ਖਿੱਚਦੇ ਸੀਗੇ ਫਿਰ ਉਹਦੇ ਬਾਅਦ ਉਹਨਾਂ ਨੂੰ ਫੋਟੋਆਂ ਨੂੰ ਪ੍ਰਿੰਟ ਕਢਾਉਣਾ ਫਿਰ ਜੇ ਕਿਸੇ ਨੂੰ ਭੇਜਣੀ ਹੈ ਤਾਂ ਫਿਰ ਉਹਦੀ ਕਾਪੀ ਕਢਾਉਣੀ ਫਿਰ ਉਹਨੂੰ ਭੇਜਣਾ ਬਟ ਅੱਜ ਕੱਲ੍ਹ ਦੇ ਜਮਾਨੇ ਦੇ ਵਿੱਚ ਫੋ ਕੈਮਰਾ ਜਿਹੜਾ ਉਹ ਫੋਨ ਦੇ ਵਿੱਚ ਹੀ ਆਉਂਦਾ ਅਤੇ ਫੋਨ ਇੱਕ ਸਭ ਤੋਂ ਸਸਤਾ ਡਿਵਾਈਸ ਕਹਿ ਸਕਦੇ ਕੈਮਰੇ ਵਾਸਤੇ ਕਿ ਕੈਮਰੇ ਅਸੀਂ ਹੁਣ ਕੁਛ ਵੀ ਕਰ ਸਕਦੇ ਹਾਂ ਫੋਨ ਤੋਂ ਜੇ ਸਾਨੂੰ ਫੋਨ ਤੋਂ ਫੋਨ ਦੇ ਕੈਮਰੇ ਤੋਂ ਹੁਣੇ ਵੀਡੀਓ ਬਣਾਉਣੀ ਹੈ ਅਤੇ ਅਸੀਂ ਵੀਡੀਓ ਵੀ ਬਣਾ ਸਕਦੇ ਹਾਂ ਬਟ ਜੇ ਇੱਦਾਂ ਕਿਸੇ ਨੂੰ ਜੇ ਕਿਸੇ ਨੂੰ ਭੇਜਣੀ ਵੀ ਪੈਂਦੀ ਹੈ ਸਾਨੂੰ ਫੋਟੋ ਤਾਂ ਅਸੀਂ ਉਹਨੂੰ ਫੋਨ ਤੋਂ ਹੀ ਭੇਜ ਸਕਦੇ ਹਾਂ ਦੂਜੇ ਫੋਨ 'ਤੇ ਅਤੇ ਨਾ ਹੀ ਉਹਨੂੰ ਕੋਈ ਕਢਾਉਣ ਦੀ ਕੋਈ ਕੁਛ ਨਾ ਕੁਛ ਨਾ ਅਸੀਂ ਔਨਲਾਈਨ ਹੀ ਸਾਰਾ ਕੁਝ ਕਰ ਸਕਦੇ ਹਾਂ ਟੈਕਨੋਲੋਜੀ ਇੰਨੀ ਵੱਧ ਚੁੱਕੀ ਹੈ ਅਤੇ ਫਿਰ ਉਹਦੇ ਬਾਅਦ ਆਪਾਂ ਜਿਵੇਂ ਕਿ ਸਾਡੀਆਂ ਅਸੀਂ ਹੁਣ ਪਹਿਲਾਂ ਥੋੜ੍ਹੀਆਂ ਬਲਰ ਆਉਂਦੀਆਂ ਹੁੰਦੀਆਂ ਸੀ ਫੋਟੋ ਇੰਨੀਆਂ ਕਲੀਅਰ ਹੀਂ ਸੀ ਆਉਂਦੀਆਂ ਹੁੰਦੀਆਂ ਕਦੀ ਕਦਾਰ ਕੈਮਰੇ ਦੇ ਵਿੱਚ ਬਟ ਹੁਣ ਇੱਦਾਂ ਦੀ ਟੈਕਨੋਲੋਜੀ ਆ ਗਈ ਕਿ ਫੋਟੋ ਆਪਣੇ ਆਪ ਹੀ ਕਲੀਅਰ ਆ ਜਾਂਦੀ ਅਸੀਂ ਉਹਨੂੰ ਵੰਨ ਏਟੀ ਪੀ ਫ਼ੋਰ ਕੇ ਏਟ ਕੇ ਤੱਕ ਲੈ ਕੇ ਜਾ ਸਕਦੇ ਹਾਂ ਹਰ ਇੱਕ ਚੀਜ਼ ਨੂੰ ਅਸੀਂ ਰਿਕਾਰਡ ਕਰ ਸਕਦੇ ਹਾਂ ਹਾਈਐਸਟ ਰੈਸਲਿਊਸ਼ਨ ਤੱਕ ਆਪਾਂ ਉਹਨੂੰ ਭੇਜ ਵੀ ਸਕਦੇ ਹਾਂ ਅਸੀਂ ਸਭ ਕੁਝ ਕਰ ਸਕਦੇ ਹਾਂ ਮੋਬਾਈਲ ਫੋਨ ਦੇ ਕੈਮਰੇ ਤੋਂ ਕਿ ਜਿਵੇਂ ਹੁਣ ਇੱਕੋ ਦਮ ਕੁਛ ਹੋ ਗਿਆ ਵਾ ਐਕਸੀਡੈਂਟ ਹੋ ਗਿਆ ਅਤੇ ਉਹਦੀ ਵੀਡੀਓ ਬਣਾ ਰਹੇ ਹਾਂ ਵੀਡੀਓ ਬਣਾ ਰਹੇ ਕਿ ਇੰਨੇ ਇਹਦੀ ਇਹ ਗਲਤੀ ਸੀਗੀ ਅਤੇ ਇਹਨੇ ਫਿਰ ਅਸੀਂ ਉਹਨੂੰ ਪੁਲਿਸ ਨੂੰ ਦਿਖਾ ਸਕਦੇ ਹਾਂ ਕਿ ਐਜ ਆ ਪਰੂਫ ਕਿ ਸਰ ਇੱਥੇ ਆਹ ਗੱਲ ਹੋਈ ਸੀਗੀ ਅਤੇ ਇਹਦੀ ਗਲਤੀ ਹੈ ਅਤੇ ਫਿਰ ਉਹ 'ਤੇ ਐਕਸ਼ਨ ਹੁੰਦਾ ਹੈ